ਛੇ ਅਪ੍ਰੈਲ ਉੱਨੀ ਸੌ ਛਿਆਨਵੇਂ ਬਾਈ ਅਕਤੂਬਰ ਉੱਨੀ ਸੌ ਸਤਾਨਵੇਂ ਇੱਕ ਜਨਵਰੀ ਉੱਨੀ ਸੌ ਨੱਬੇ ਚੌਦ੍ਹਾਂ ਅਪ੍ਰੈਲ ਉੱਨੀ ਸੌ ਸੱਤਰ ਪੰਜ ਮਈ ਦੋ ਹਜ਼ਾਰ ਤੇਈ